ਮੈਂ ਭਾਰਤ ਦੇਸ਼ ਦਾ ਰਹਿਣ ਵਾਲਾ ਨਿਵਾਸੀ ਹਾਂ ਮੇਰੇ ਮੁਤਾਬਕ ਅਸੀਂ ਬ੍ਰਹਿਮੰਡ ਨੂੰ ਦੇਖ ਤਾਂ ਨਹੀਂ ਸਕਦੇ ਪਰ ਉਸਨੂੰ ਮਹਿਸੂਸ ਤਾਂ ਜ਼ਰੂਰ ਕਰ ਸਕਦੇ ਹਾਂ ਅਸੀਂ ਟੀ ਵੀ ਟੈਲੀਵਿਜ਼ਨ ਜਾਂ ਫੇਰ ਰੇਡੀਓ 'ਤੇ ਉਸਦੇ ਬਾਰੇ ਸੁਣ ਕੇ ਜਾਂ ਦੇਖ ਕੇ ਉਸਦਾ ਅੰਦਾਜ਼ਾ ਵੀ ਲਾ ਸਕਦੇ ਹਨ ਇਸਦਾ ਰਹੱਸ ਬਹੁਤ ਡੂੰਘਾ ਅਤੇ ਗੰਭੀਰ ਹੈ ਰਹੱਸ ਇਹ ਹੈ ਕਿ ਇਸ ਬ੍ਰਹਿਮੰਡ ਵਿੱਚ ਕੁੱਲ ਅੱਠ ਧਰਤੀਆਂ ਹਨ ਜਿਸ ਇਸ ਵਿੱਚ ਇੱਕ ਧਰਤੀ ਸਾਡੀ ਇਸਨੂੰ ਅਰਥ ਵੀ ਕਿਹਾ ਜਾਂਦਾ ਹੈ ਬਟ ਫੇਰ ਵੀ ਇਸ ਧਰਤੀ ਨਾਲ ਕੋਈ ਵੀ ਮੁਕਾਬਲਾ ਕੋਈ ਹੋਰ ਧਰਤੀ ਨਹੀਂ ਕਰ ਸਕਦੀ ਇਸ ਵਿੱਚ ਹਵਾ ਪਾਣੀ ਰਹਿਣ ਸਹਿਣ ਜੀਵ ਜੰਤੂ ਪੇੜ ਪੌਦੇ ਆਦਿ ਕਈਆਂ ਪ੍ਰਕਾਰ ਦੇ ਜੀਵ ਕਈਆਂ ਪ੍ਰਕਾਰ ਦੀ ਜੜੀ ਬੂਟੀਆਂ ਕਈਆਂ ਪ੍ਰਕਾਰ ਦੇ ਲੋਕ ਵੀ ਪਾਏ ਜਾਂਦੇ ਹਨ ਇਹ ਇੱਕ ਵੱਧਦਾ ਹੋਇਆ ਧਰਤੀ ਜਾਂ ਦੇਸ਼ ਹੈ ਜਿਸ ਨਾਲ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ ਇਸ ਵਿੱਚ ਹਵਾ ਦੇ ਨਾਲ ਨਾਲ ਪਾਣੀ ਦਾ ਵੀ ਪੂਰਾ ਸੰਤੁਲਨ ਪੂਰਾ ਬਰਕਰਾਰ ਹੈ ਇਸ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ